ਪੰਜਾਬੀ ਭਾਸ਼ਾ ਜਦੋਂ ਆਪਾਂ ਕਿਸੇ ਨਾਲ ਆਪਣੀ ਗੱਲ ਕਰਨੀ ਹੈ ਨਾ ਤਾਂ ਜਿੰਨਾ ਆਪਾਂ ਆਪਣੀ ਮਾਂ ਬੋਲੀ ਦੇ ਵਿੱਚ ਕਿਸੇ ਨੂੰ ਸਮਝਾਉਂਦੇ ਹਾਂ ਨਾ ਦੂਜੇ ਸਾਹਮਣੇ ਵਾਲੇ ਬੰਦੇ ਨੂੰ ਓਨਾ ਹੀ ਸਮਝ ਆਉਂਦਾ ਹੈ ਹੁਣ ਜੇ ਮੈਂ ਕੁਛ ਕਮਾਉਣਾ ਹੈ ਕੁਛ ਕੰਮ ਕਰਨਾ ਹੈ ਤਾਂ ਕਿਆ ਕੋਈ ਚੀਜ਼ ਵੇਚਣੀ ਹੈ ਤਾਂ ਮੈਂ ਉਸ ਦੇ ਬਾਰੇ ਉਹਨੂੰ ਪੰਜਾਬੀ ਦੇ ਵਿੱਚ ਹੀ ਜੇ ਸਮਝਾਵਾਂਗਾ ਨਾ ਤਾਂ ਉਹ ਸਾਹਮਣੇ ਵਾਲਾ ਬੰਦਾ ਕਿਉਂਕਿ ਪੰਜਾਬੀ ਚੰਗੀ ਤਰ੍ਹਾਂ ਸਮਝਦਾ ਉਹਨੂੰ ਵੀ ਸਮਝ ਆਵੇਗੀ ਨਹੀਂ ਤਾਂ ਮੈਂ ਜੇ ਕੋਈ ਹੋਰ ਭਾਸ਼ਾ ਬੋਲੀ ਗਿਆ ਵਿੱਚ ਇੰਗਲਿਸ਼ ਬੋਲੀ ਗਿਆ ਕੋਈ ਹੋਰ ਸਮਝਾਈ ਗਈ ਤਾਂ ਉਹ ਉਹਨਾਂ ਨੂੰ ਸਮਝ ਨਹੀਂ ਆਉਣੀ ਜਿੰਨੀ ਪੰਜਾਬੀ 'ਚ ਸਮਝ ਆਏਗੀ ਅਤੇ ਮੈਂ ਉਹਨਾਂ ਨੂੰ ਅੱਛੇ ਤਰੀਕੇ ਨਾਲ ਕਨਵੈਂਸ ਕਰ ਸਕਦਾ ਸਮਝਾ ਸਕਦਾ ਹੈ ਕਿ ਭਾਈ ਤੁਸੀਂ ਇਹ ਮੇਰਾ ਪ੍ਰੋਡਕਟ ਲਉ ਜੇ ਤੁਸੀਂ ਇਸ ਨੂੰ ਲਵੋਂਗੇ ਖਰੀਦੋਂਗੇ ਤਾਂ ਉਸ ਦੇ ਪੈਸੇ ਮੈਨੂੰ ਮਿਲੂੰਗੇ ਤਾਂ ਉਸ ਪੈਸਿਆਂ ਨਾਲ ਮੇਰੀ ਵੀ ਆਰਥਿਕਤਾ ਅੱਗੇ ਚੱਲੇਗੀ